ਗਰਮੀਆਂ ਦਾ ਮੌਸਮ ਸ਼ੁਰੂ ਹੋਣ ਲੱਗਾ ਹੈ ਅਤੇ ਮੈਂ ਸੋਚ ਰਹੀ ਸੀ ਕਿ ਮੈਂ ਕੋਈ ਕੁੜਤਾ ਖਰੀਦਾਂ ਇਸਦੇ ਲਈ ਮੈਂ ਨਾ ਮਿੰਨਤਰਾ ਐਪ 'ਤੇ ਸਰਚ ਕਰਨੀ ਸ਼ੁਰੂ ਕੀਤੀ ਅਤੇ ਦੇਖਦਿਆ ਦੇਖਦਿਆ ਮੈਨੂੰ ਨਾ ਲਿਬਾਸ ਦੀ ਉਹ 'ਤੇ ਮੈਂ ਗਈ ਅਤੇ ਲਿਬਾਸ ਦਾ ਮੈਨੂੰ ਇੱਕ ਕੁੜਤਾ ਜਿਹੜਾ ਹੈ ਉਹ ਬਹੁਤ ਪਸੰਦ ਆਇਆ ਅਤੇ ਮੈਂ ਅ ਮਤਲਬ ਉਹਦਾ ਕਲਰ ਵੀ ਬਹੁਤ ਅੱਛਾ ਸੀਗਾ ਬਲੂ ਕਲਰ ਸੀਗਾ ਅਤੇ ਮੈਂ ਉਹ ਖਰੀਦ ਲਿਆ ਮਤਲਬ ਔਡਰ ਕਰ ਦਿੱਤਾ ਅਤੇ ਫਿਰ ਜਦੋਂ ਤਿੰਨ ਚਾਰ ਦਿਨ ਦੇ ਬਾਅਦ ਜਦੋਂ ਉਹ ਕੁੜਤਾ ਮੈਨੂੰ ਮਿਲਿਆ ਅਤੇ ਜਦੋਂ ਮੈਂ ਪਾਰਸਲ ਖੋਲਿਆ ਅਤੇ ਪਾਰਸਲ ਖੋਲ ਕੇ ਮੈਂ ਦੇਖਿਆ ਅਤੇ ਕੁੜਤਾ ਜੋ ਕਲਰ ਮੈਨੂੰ ਚਾਹੀਦਾ ਸੀ ਜੋ ਰੰਗ ਮੈਨੂੰ ਚਾਹੀਦਾ ਸੀ ਉਹਦਾ ਬਲੂ ਐਗਜੈਕਟ ਉਹ ਹੀ ਸੀਗਾ ਅਤੇ ਜਦੋਂ ਮੈਂ ਮਤਲਬ ਉਸਦਾ ਜਦੋਂ ਮੈਂ ਪਹਿਨ ਕੇ ਦੇਖਿਆ ਤਾ ਬਿਲਕੁਲ ਫਿੱਟ ਸੀਗਾ ਕਿਉਂਕਿ ਮੈਂ ਲਾਰਜ ਸਾਈਜ ਔਡਰ ਕੀਤਾ ਸੀ ਅਤੇ ਲਾਰਜ ਹੀ ਆਇਆ ਸੀ ਮੈਨੂੰ ਉਹ ਹੀ ਫਿਟ ਬਹਿੰਦਾ ਅਤੇ ਜਦੋਂ ਉਹ ਫਿਰ ਮੈਂ ਦੇਖਿਆ ਕਿ ਉਹਦਾ ਜਿਹੜਾ ਮਤਲਬ ਲੈਂਥ ਵੀ ਜਿਹੜੀ ਸੀ ਉਹ ਬਿਲਕੁਲ ਪਰਫੈਕਟ ਸੀਗੀ ਜਿੰਨੀ ਲੈਂਥ ਮੈਨੂੰ ਚਾਹੀਦੀ ਸੀ ਅਤੇ ਉਹਦੀ ਫਿਟਿੰਗ ਬਿਲਕੁਲ ਬ ਮਤਲਬ ਪ ਪਰਫੈਕਟ ਸੀਗੀ ਕੋਈ ਮਤਲਬ ਲੂਸ ਨਹੀਂ ਸੀਗਾ ਨਾ ਟਾਈਟ ਸੀਗਾ ਅਤੇ ਬਹੁਤ ਹੀ ਵਧੀਆ ਸੀ ਫਿਰ ਸਭ ਤੋਂ ਵੱਧ ਮਤਲਬ ਜਿਹੜਾ ਹੈਗਾ ਕਿ ਮੈਨੂੰ ਨਾ ਜੋ ਇਹਦੇ ਵਿੱਚ ਲੱਗਾ ਇਹਦਾ ਜਿਹੜਾ ਮਤਲਬ ਵਰਕ ਜਿਹੜਾ ਹੈ ਉਹ ਵੀ ਬਹੁਤ ਵਧੀਆ ਸੀਗਾ ਕੋਈ ਮਤਲਬ ਟਾਈਟ ਨਹੀਂ ਸੀ ਬਾਹਾਂ 'ਤੇ ਵੀ ਵਰਕ ਸੀਗਾ ਗਲੇ 'ਤੇ ਸੀ ਔਰ ਫਰੰਟ 'ਤੇ ਸੀਗਾ ਮਤਲਬ ਵਰਕ ਕੀਤਾ ਹੋਇਆ ਔਰ ਸਭ ਤੋਂ ਵਧੀਆ ਜਿਹੜੀ ਚੀਜ਼ ਸੀ ਇਹਦੇ ਵਿੱਚ ਉਹ ਸੀਗੀ ਕਿ ਇਹਦੀ ਇਹਦਾ ਜਿਹੜਾ ਫੈਬਰਿਕ ਸੀਗਾ ਨਾ ਕੁੜਤੇ ਦਾ ਉਹ ਬਹੁਤ ਹੀ ਵਧ ਵਧੀਆ ਸੀ ਸੋਫਟ ਸੀਗਾ ਜਿਹੋ ਜਿਹਾ ਮੈਨੂੰ ਮਤਲਬ ਚਾਹੀਦਾ ਸੀ ਮਟੀਰੀਅਲ ਉਹ ਜਿਹਾ ਹੀ ਮਿਲਿਆ ਸੋ ਕੁੱਲ ਮਿਲਾ ਕੇ ਮੈਨੂੰ ਤਾਂ ਬਹੁਤ ਹੀ ਵਧੀਆ ਮਤਲਬ ਮੇਰਾ ਜਿਹੜਾ ਫਸਟ ਐਕਸਪੀਰੀਅੰਸ ਜਿਹੜਾ ਰਿਹਾ ਉਹ ਬਹੁਤ ਹੀ ਵਧੀਆ ਰਿਹਾ